ਭੰਗੜੇ ਦੇ ਵਿੱਚ ਕੁਝ ਆਮ ਸਟੈਪ ਆਮ ਸਟੈਪ ਤਾਂ ਨਹੀਂ ਕਹੂੰਗਾ ਸਟੈਪ ਹਨ ਜਿਵੇਂ ਕਿ ਆਪਣਾ ਭਲਵਾਨੀ ਭਲਵਾਨੀ ਦੌਰ ਲੁੱਡੀ ਉਹਦੇ ਬਾਅਦ ਸ਼ਲਾਂਘ ਆਦਿ ਇਹ ਭੰਗੜੇ ਦੇ ਕੁਝ ਆਮ ਅਤੇ ਕੁਝ ਖ਼ਾਸ ਕੁ ਮਤਲਬ ਕਿ ਉਹ ਹਨ ਇਹਨਾਂ ਵਿੱਚ ਪੰਜਾਬ ਦੇ ਮਤਲਬ ਕਿ ਬਹੁਤ ਹਰੇਕ ਤਰ੍ਹਾਂ ਅਲੱਗ ਅਲੱਗ ਮਨਾਇਆ ਜਾਂਦਾ ਹੈ ਜਿਵੇਂ ਕਿ ਜੇ ਸਕੂਲ ਜਾਂ ਕਾਲਜਾਂ ਵਿੱਚ ਇਹ ਸਟੈਪ ਹਨ ਇਹ ਜ਼ਿਆਦਾ ਤੌਰ 'ਤੇ ਮੁਕਾਬਲਿਆਂ ਦੇ ਤੌਰ ਵਿੱਚ ਵਰਤੇ ਜਾਂਦੇ ਹਨ ਅਤੇ ਜਸ਼ਨ ਵਾਲੇ ਸੁਭਾਅ ਵਿੱਚ ਇਹ ਯੋਗਦਾਨ ਬਹੁਤ ਤਰ੍ਹਾਂ ਪਾਉਂਦੇ ਹਨ ਜਿਵੇਂ ਕਿ ਜੇ ਵਿਆਹ ਹੋਵੇ ਕਿਸੇ ਦਾ ਤਾਂ ਜੋ ਵੀ ਭੰਗੜੇ ਵਾਲੇ ਆਉਂਦੇ ਹਨ ਤਾਂ ਜ਼ਿਆਦਾ ਕਰਕੇ ਲੁੱਡੀ ਜਾਂ ਸ਼ਲਾਂਘ ਦੀ ਵਰਤੋਂ ਕੀਤੀ ਜਾਂਦੀ ਹਨ ਭੰਗੜਿਆਂ ਦੇ ਨਾਲ ਨਾਲ ਆਪਣੇ ਪੰਜਾਬੀ ਲੋਕ ਨਾਚ ਵਿੱਚ ਜਿਵੇਂ ਕਿ ਗਿੱਧਾ ਹੈ ਗਿੱਧਾ ਮੁਟਿਆਰਾਂ ਦਾ ਆਪਣਾ ਤੀਵੀਆਂ ਦਾ ਇਸਤਰੀਆਂ ਦਾ ਇਹ ਲੋ ਫੇਵਰੇਟ ਲੋਕ ਨਾਚ ਹੈ ਭੰਗੜੇ ਦੇ ਨਾਂ ਨਾਲ ਗਿੱਧੇ ਦਾ ਵੀ ਟੂਰਨਾ ਟੂਰਨਾਮੈਂਟ ਕਹਿ ਸਕਦੇ ਹਨ ਅਸੀਂ ਮੁਕਾਬਲੇ ਕਰਵਾਏ ਜਾਂਦੇ ਹਨ ਆਪਣਾ ਉਹ ਆਮ ਚਲਦੇ ਹਨ ਆਪਣਾ ਪੰਜਾਬ ਦੇ ਵਿੱਚ ਸਕੂਲਾਂ ਕਾਲਜਾਂ ਵਿੱਚ ਇਹਨਾਂ ਦੀ ਜਾਗਰੂਕਤਾ ਕਰਵਾਈ ਗਈ ਅਤੇ ਆਨਲਾਈਨ ਅਤੇ ਜ਼ਮਾਨੇ ਵਿੱਚ ਆਨਲਾਈਨ ਦੇ ਨਾਲ ਨਾਲ ਇਹ ਚੈਨਲ ਬਣੇ ਹਨ ਕਿ ਭੰਗੜਾ ਸਟੈਪ ਸਿੱਖਣ ਦੇ ਲਈ ਇੱਦਾਂ ਨਹੀਂ ਇੱਦਾਂ ਫੀਸਾਂ ਅਲੱਗ ਅਲੱਗ ਪਹਿਲਾਂ ਫਰੀ ਕਰਵਾ ਦਿੰਦੇ ਸੀ ਕੋਚ ਹੁਣ ਆਨਲਾਈਨ ਹਰੇਕ ਅੱਜ ਦੇ ਜ਼ਮਾਨੇ ਵਿੱਚ ਹਰੇਕ ਹੀ ਕੋਚ ਹੈ ਆਪਣਾ ਭੰਗੜੇ ਦਾ ਕਿ ਜਸ਼ਨ ਦੇ ਤੌਰ 'ਤੇ ਆਮ ਕਰਕੇ ਪੰਜਾਬ ਹਰਿਆਣਾ ਅਤੇ ਹੁਣ ਬਾਹਰਲੇ ਦੇਸ਼ਾਂ ਜਿਵੇਂ ਕਨੇਡਾ ਅਮਰੀਕਾ ਵਿੱਚ ਵੀ ਭੰਗੜੇ ਦੀ ਗੂੰਜ ਫੈਲ ਰਹੀ ਹੈ ਹਾਂਜੀ ਅਤੇ ਬਹੁਤ ਹੀ ਪ੍ਰਸਿੱਧ ਹੈ